ਸਰਕਾਰ ਅੱਜ ਜਿਵੇਂ ਕੋਈ ਛੋਟੇ ਛੋਟੇ ਵਿਅਕਤੀ ਘਰੇਲੂ ਜਿਹੜੇ ਵਪਾਰ ਕਰਨਾ ਚਾਹੁੰਦੇ ਹੈ ਸਰਕਾਰ ਉਹਨਾਂ ਨੂੰ ਨਵੀਆਂ ਨਵੀਆਂ ਨੀਤੀਆਂ ਬਾਰੇ ਦੱਸਦੀ ਹੈ ਉਹਨਾਂ ਨੂੰ ਉਹਨਾਂ ਨੂੰ ਰੁਜ਼ ਕਾਰੋਬਾਰ ਬਣਾਉਣ ਲਈ ਲੋਨ ਪ੍ਰੋਵਾਈਡ ਕਰਦੇ ਹਨ ਉਹਨਾਂ ਨੂੰ ਬਿਹਤਰ ਸਿੱਖਣ ਲਈ ਟੀਚਰ ਦਾ ਪ੍ਰਬੰਧ ਕਰਦੇ ਹਨ ਜਿਸ ਨਾਲ ਉਹ ਆਪਣੇ ਘਰ ਬੈਠੇ ਹੀ ਇੱਕ ਛੋਟਾ ਜਿਹਾ ਸ ਰੋਜ਼ਗਾਰ ਆਪਣੇ ਪਰਿਵਾਰ ਅਤੇ ਆਪਣੇ ਜਿਹੜੀ ਇਨਕਮ ਦਾ ਸਾਧਨ ਬਣਾ ਸਕਦੇ ਹਨ ਜਿਸ ਨਾਲ ਉਹ ਇੱਕ ਵਧੀਆ ਇੱਕ ਜੀਵਨ ਬਤੀਤ ਕਰ ਸਕਣ ਸਰਕਾਰ ਦੁਆਰਾ ਵੱਖ ਵੱਖ ਯੋਜਨਾਵਾਂ ਸਮੇਂ ਸਮੇਂ ਸਾਰਿਆਂ ਨੂੰ ਗਾਈਡ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਇਹਨਾਂ ਦਾ ਜਿਹੜਾ ਭ ਭਵਿੱਖ ਜਿਹੜਾ ਸੁਰੱਖਿਅਤ ਰਵੇ ਅਤੇ ਛੋਟੇ ਕਾਰੋਬਾਰ ਨੂੰ ਵਧੀਆ ਅਤੇ ਘੱਟ ਵਿਆਜ਼ ਦਰ ਨਾਲ ਲੋਨ ਪ੍ਰਾਪਤ ਕਰਕੇ ਇਹਨਾਂ ਦੀ ਮਦਦ ਕਰਦੇ ਹਨ